ਮੈਂ ਲੁੱਡੋ ਅਤੇ ਕੈਰਮ ਸੱਪ ਅਤੇ ਪੌੜੀ ਖੇਡੀ ਹੈ ਲੁੱਡੋ ਵਿੱਚ ਪਹਿਲੇ ਤਾਂ ਇੱਕ ਲੁੱਡੋ ਹੁੰਦੀ ਹੈ ਉਸ ਵਿੱਚ ਇੱਕ ਤੋਂ ਲੈ ਕੇ ਸੌ ਤੱਕ ਗਿਣਤੀ ਹੁੰਦੀ ਹੈ ਅਤੇ ਇੱਕ ਡਾਇਸ ਹੁੰਦਾ ਹੈ ਡਾਇਸ ਉੱਤੇ ਨੰਬਰ ਬਣੇ ਹੁੰਦੇ ਹਨ ਇੱਕ ਤੋਂ ਲੈ ਕੇ ਛੇ ਤੱਕ ਡਾਇਸ ਉੱਤੇ ਨੰਬਰ ਬਣੇ ਹੁੰਦੇ ਹਨ ਇਸ ਨੂੰ ਚੁੱਕ ਕੇ ਘੁੰਮਾਉਣ ਨਾਲ ਡਾਇਸ 'ਤੇ ਛੇ ਆਉਣ ਨਾਲ ਉਸ ਨੂੰ ਅੱਗੇ ਗੀਟੀ ਨੂੰ ਵਧਾਇਆ ਜਾਂਦਾ ਹੈ ਅਤੇ ਆਪਣੀ ਚਾਲ ਚੱਲੀ ਜਾਂਦੀ ਹੈ ਚਾਲ ਨੂੰ ਅੱਗੇ ਅੱਗੇ ਚਲਦੇ ਜਾਣਾ ਪੈਂਦਾ ਹੈ ਅਤੇ ਕਈ ਬਾਰ ਸੱਪ ਡੱਸ ਲੈਂਦਾ ਹੈ ਅਤੇ ਕਈ ਬਾਰ ਪੌੜੀਆਂ ਹੁੰਦੀਆਂ ਹਨ ਇਸ ਵਿੱਚ ਥਾਂ ਥਾਂ ਸੱਪ ਅਤੇ ਪੌੜੀਆਂ ਬਣੀਆਂ ਹੁੰਦੀਆਂ ਹਨ ਜਿਹੜਾ ਬੰਦਾ ਆਪਣੀਆਂ ਚਾਰੀਆਂ ਗੀਟੀਆਂ ਨੂੰ ਸੌ ਤੋਂ ਪਾਰ ਟੱਪ ਲੈਂਦਾ ਹੈ ਉਹ ਲੁੱਡੋ ਦੀ ਗੇਮ ਜਿੱਤ ਲੈਂਦਾ ਹੈ ਇਸ ਤੋਂ ਇਲਾਵਾ ਮੈਂ ਕੈਰਮ ਵੀ ਖੇਡਿਆ ਹੈ ਕੈਰਮ ਵਿੱਚ ਇੱਕ ਵੱਡਾ ਜਿਹਾ ਕੈਰਮ ਹੁੰਦਾ ਹੈ ਜਿਸ ਦੀਆਂ ਚਾਰ ਸਾਈਡਾਂ ਹੁੰਦੀਆਂ ਹਨ ਹਰ ਸਾਈਡ ਵਿੱਚ ਆਪਣੇ ਆਪਣੇ ਬੰਦੇ ਨੂੰ ਬਿਠਾਇਆ ਜਾਂਦਾ ਹੈ ਇੱਕ ਇੱਕ ਬੰਦੇ ਨੂੰ ਬਿਠਾਇਆ ਜਾਂਦਾ ਹੈ ਤੇ ਗੱਬੇ ਗੀਟੀਆਂ ਲਗਾਈਆਂ ਜਾਂਦੀਆਂ ਹਨ ਅਤੇ ਕੈਰਮ ਵਿੱਚ ਸਾਈਡ ਸਾਈਡ 'ਤੇ ਮੋਰੇ ਬਣੇ ਹੁੰਦੇ ਹਨ ਜਿਸ ਵਿੱਚ ਗੀਟੀ ਨੂੰ ਪਾਉਣਾ ਹੁੰਦਾ ਹੈ ਇਸ ਵਿੱਚ ਇੱਕ ਰਾਣੀ ਵੀ ਹੁੰਦੀ ਹੈ ਉਸ ਨੂੰ ਪਾਉਣ ਤੋਂ ਮਗਰੋਂ ਇੱਕ ਗੀਟੀ ਹੋਰ ਪਾਣੀ ਹੁੰਦੀ ਹੈ ਅਤੇ ਰਾਣੀ ਉਸ ਦੀ ਹੁੰਦੀ ਹੈ ਅ ਜੋ ਰਾਣੀ ਜਿੱਤ ਲੈਂਦਾ ਹੈ ਉਹ ਪੂਰੀ ਕੈਰਮ ਨੂੰ ਜਿੱਤ ਲੈਂਦਾ ਹੈ ਪੂਰੀਆਂ ਗੀਟੀਆਂ ਉਸ ਦੀਆਂ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਇੱਕ ਵੱਡਾ ਠੀਕਰ ਹੁੰਦਾ ਹੈ ਜਿਸ ਨੂੰ ਮਾਰਿਆ ਜਾਂਦਾ ਹੈ ਬਾਕੀ ਗੀਟੀਆਂ ਵਿੱਚ ਅਤੇ ਫਿਰ ਗੀਟੀ ਨੂੰ ਉਸ ਵਿੱਚ ਗੋਲੇ ਵਿੱਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਜੋ ਰਾਣੀ ਜਿੱਤ ਲੈਂਦਾ ਹੈ ਉਹ ਸਾਰੀਆਂ ਗੀਟੀਆਂ ਜਿੱਤ ਲੈਂਦਾ ਹੈ ਧੰਨਵਾਦ